ਹੈਲੋ ਹਾਂਜੀ ਗੁੱਡ ਮੋਰਨਿੰਗ ਜੀ ਹੋਰ ਕਿੱਦ ਕਿੱਦਾਂ ਹਾਲ ਜੀ ਅਸੀਂ ਇੱਕ ਨਾ ਗਾਇਡੈਂਸ ਲੈਣੀ ਜੀ ਤੁਹਾਡੇ ਕੋਲੋ ਪੰਜਾਬ ਦੇ ਵਿੱਚ ਅਸੀਂ ਇਤਿਹਾਸਕ ਥਾਵਾਂ ਤੇ' ਘੁੰਮਣਾ ਫਿਰਨਾ ਚਾਹੁੰਦੇ ਹਾਂ ਉਹਦੇ ਬਾਰੇ ਸਾਨੂੰ ਤੁਹਾਡੇ ਤੋਂ ਜਾਣਕਾਰੀ ਪਤਾ ਲੱਗ ਜੇ ਵੀ ਕਿਵੇਂ ਕਿਵੇਂ ਆ ਸਾਰਾ ਕੁੱਝ ਦੱਸੋਂਗੇ

ਜੀ ਸਰ ਜੀ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਇਹ ਫਿਰ ਲੈ ਕੇ ਜਾਣ ਦਾ ਜੀ ਉੱਥੇ ਜਾਂ ਫਿਰ ਰਹਿਣ ਸਹਿਣ ਦਾ ਕੋਈ ਕਿਵੇਂ ਕੋਈ ਪ੍ਰੋਗਰਾਮ ਖ਼ਰਚਾ ਪਾਣੀ ਕਿੱਦਾਂ ਉਹ ਅਰੇਜਮੈਂਟ ਕੀ ਲੱਗਦਾ ਜੀ ਅਸੀਂ ਇੱਥੋ ਪੰਜਾਬ ਤੋਂ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਨਾਲ਼ ਚੱਲੂਗੇ ਤੁਸੀਂ ਠੀਕ ਹੈ ਫਿਰ ਤਾਂ ਵਧੀਆ ਦਿਲ ਲੱਗਿਆ ਰਹੂਗਾ ਠੀਕ ਹੈ ਅਤੇ ਖ਼ਰਚਾ ਪਾਣੀ ਕਿੰਨਾਂ ਕੁ ਚਾਰਜ ਹੋਊਗਾ ਜੀ ਫਿਰ ਆਹ ਡੇਲੀ ਦਾ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਚਲੋ ਧੰਨਵਾਦ ਜੀ ਓਕੇ ਓਕੇ ਓਕੇ